ਹਰੇਕ ਮਨੁੱਖ ਦੀ ਕੋਈ ਨਾ ਕੋਈ ਕਲਾ ਹੁੰਦੀ ਹੈ ਅਤੇ ਉਸ ਕਲਾ ਨੂੰ ਪ੍ਰਦਰਸ਼ਨ ਕਰਨ ਲਈ ਉਹ ਹਰ ਵੱਖਰੇ ਵੱਖਰੇ ਕਿੱਤੇ ਨੂੰ ਅਪਣਾਉਂਦਾ ਹੈ ਜਿਵੇਂ ਕਿ ਗੱਲ ਕੀਤੀ ਜਾਵੇ ਗਾਇਨ ਗਾਇਕੀ ਇੱਕ ਅਜਿਹਾ ਕਿੱਤਾ ਹੈ ਜਿਸ ਨੂੰ ਅਸੀਂ ਆਪਣੇ ਇੱਕ ਮਨੋਰੰਜਨ ਦੇ ਤੌਰ 'ਤੇ ਵੀ ਲੈ ਸਕਦੇ ਹਾਂ ਕਈ ਮਨੁੱਖਾਂ ਨੂੰ ਗਾਇਨ ਕਰਦੇ ਸਮੇਂ ਸਾਹ ਦੀ ਸਮੱਸਿਆ ਆਉਂਦੀ ਹੈ ਉਹ ਸਾਹ 'ਤੇ ਨਿਯੰਤਰਣ ਨਹੀਂ ਕਰ ਸਕਦੇ ਹਨ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਸਾਨੂੰ ਵੱਧ ਤੋਂ ਵੱਧ ਅਭਿਆਸ ਕਰਨ ਦੀ ਲੋੜ ਹੈ ਅਸੀਂ ਵੱਧ ਤੋਂ ਵੱਧ ਇਸਦਾ ਅਭਿਆਸ ਕਰਕੇ ਅਤੇ ਕੁਛ ਅਦਾਰਿਆਂ ਨੂੰ ਸ਼ਾਮਿਲ ਕਰ ਸਕਦੇ ਹਾਂ ਜਿਨ੍ਹਾਂ 'ਤੇ ਜਾ ਕੇ ਅਸੀਂ ਇਹਨਾਂ ਦੀ ਸਿਖਲਾਈ ਲੈ ਸਕਦੇ ਹਾਂ ਅਤੇ ਇਸ ਅਭਿਆਸ ਦੀ ਨਿਯੰਤਰਣ ਵਰਤੋਂ ਕਰਕੇ ਅਸੀਂ ਇਸ ਦੋ ਸੁਧਾਰਿਆ ਜਾ ਸਕਦਾ ਹੈ ਕੁਛ ਮਨੁੱਖਾਂ ਨੂੰ ਦੂਸਰਿਆਂ ਸਾਹਮਣੇ ਗਾ ਗਾਇਨ ਕਰਦੇ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਉਹ ਖੁੱਲ੍ਹ ਕੇ ਲੋਕਾਂ ਸਾਹਮਣੇ ਨਹੀਂ ਗਾ ਸਕਦੇ ਪਰ ਜੇਕਰ ਅਸੀਂ ਵੱਧ ਤੋਂ ਵੱਧ ਅਭਿਆਸ ਕਰ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਗਾਇਆ ਗਾ ਕੇ ਅਭਿਆਸ ਕਰਕੇ ਅਤੇ ਲੋਕਾਂ ਸਾਹਮਣੇ ਆਪਣਾ ਪ੍ਰਦਰਸ਼ਨ ਕਰਕੇ ਇਸ ਨੂੰ ਸੁਧਾਰ ਸਕਦੇ ਹਾਂ ਅਤੇ ਇਹ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ